ਅੱਜ ਕੱਲ੍ਹ ਫੈਸ਼ਨ ਡਿਜ਼ਾਇਨ ਦਾ ਬਹੁਤ ਰਿਵਾਜ਼ ਹੋ ਗਿਆ ਹੈ ਹਰ ਕੋਈ ਬਿਨਾਂ ਡਿਜ਼ਾਇਨ ਤੋਂ ਕੋਈ ਕੱਪੜਾ ਨਹੀਂ ਪਾਉਣਾ ਪਸੰਦ ਕਰਦਾ ਛੋਟੀ ਤੋਂ ਛੋਟੀ ਚੀਜ਼ ਵੀ ਡਿਜ਼ਾਇਨ ਕੀਤੀ ਹੋਣੀ ਚਾਹੀਦੀ ਹੈ ਜਿਵੇਂ ਕਿ ਕੈਪ ਜਰਾਬਾਂ ਦਸਤਾਨੇ ਆਦਿ ਹਰ ਕੋਈ ਆਪਣੇ ਆਪ ਨੂੰ ਵੱਖਰਾ ਦਿਖਾਉਣਾ ਚਾਹੁੰਦਾ ਹੈ ਕੰਪਨੀਆਂ ਵਾਲੇ ਵੀ ਹਰ ਸਾਲ ਨਵੇਂ ਤੋਂ ਨਵੇਂ ਡਿਜ਼ਾਇਨ ਮਾਰਕੀਟ ਵਿੱਚ ਭੇਜ ਕੇ ਲੋਕਾਂ ਨੂੰ ਖਰੀਦਣ ਲਈ ਮਜਬੂਰ ਕਰਦੇ ਹਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕੰਪਨੀਆਂ ਹਰ ਇੱਕ ਦਾ ਖਿਆਲ ਰੱਖਦੀਆਂ ਹਨ ਜ਼ਿਆਦਾਤਰ ਲੜਕੀਆਂ ਦੀਆਂ ਡਰੈਸਾਂ ਦਾ ਹਰ ਦਿਨ ਨਵਾਂ ਡਿਜ਼ਾਇਨ ਦੇਖਣ ਨੂੰ ਮਿਲਦਾ ਹੈ ਇਸ ਤਰ੍ਹਾਂ ਇਸ਼ਤਿਹਾਬਾਜ਼ੀ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਲੋਕ ਇੱਕ ਚੈਨਲ 'ਤੇ ਆਪਣਾ ਪੇਜ ਬਣਾ ਕੇ ਆਪਣੇ ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਦਿਖਾ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਨਾਲ ਬਹੁਤ ਜਲਦੀ ਹੀ ਸਾਡੇ ਕੰਮ ਬਾਰੇ ਪਤਾ ਲੱਗ ਜਾਂਦਾ ਹੈ ਪਹਿਲਾਂ ਗਰੁੱਪਾਂ ਵਿੱਚ ਫਿਰ ਸਟੇਟਸ ਦੀ ਅਤੇ ਫਿਰ ਆਪਣੇ ਪੇਜ 'ਤੇ ਪਰ ਅੱਜ ਕੱਲ੍ਹ ਇਸ਼ਤਿਹਾਰਬਾਜ਼ੀ ਇੰਨੀ ਵੱਧ ਗਈ ਹੈ ਕਿ ਸਮਝ ਨਹੀਂ ਲੱਗਦੀ ਕਿ ਸਹੀ ਕੀ ਹੈ ਅਤੇ ਗਲਤ ਕੀ ਪੈਸੇ ਲਈ ਹਰ ਕੋਈ ਆਪਣੀ ਐਡ ਕਰ ਰਿਹਾ ਹੈ